ਹੈਲੋ ਹਾਂਜੀ

ਅੱਛਾ ਅੱਛਾ ਪਲੱਸ ਟੂ ਤੇਰੀ ਪਾਸ ਹੋ ਗਈ ਹੈ ਬਾਹਰ ਬੇਟਾ ਪਹਿਲੋਂ ਇੱਦਾਂ ਨਹੀਂ ਕਰ ਜਾਈਦਾ ਪਹਿਲਾਂ ਕੋਈ ਕੰਮ ਕੁੰਮ ਸਿੱਖ ਲਾ ਬਾਹਰ ਜਾ ਕੇ ਖੱਜਲ ਨਹੀਂ ਹੋਣਾ ਪਹਿਲੋਂ ਮਾਹੌਲ ਹੋਰ ਸੀ ਹੁਣ ਮਾਹੌਲ ਹੋਰ ਆ ਅਤੇ ਪਹਿਲਾਂ ਕੋਈ ਕੋਰਸ ਕਰੋ ਅਤੇ ਕੰਮ ਜਾਂ ਕੋਈ ਚੰਗਾ ਹੱਥੀਂ ਸਿੱਖੋ ਅਤੇ ਜਿਹੜਾ ਤੁਸੀਂ ਬਾਹਰ ਜਾ ਕੇ ਕਰ ਸਕੋ ਕੰਮ ਜਿਹੜਾ ਤੈਨੂੰ ਠੀਕ ਲੱਗਦਾ ਉਹ ਸਿੱਖ ਲਾ ਅਤੇ ਜਿਹੜਾ ਤੇਰਾ ਫਾਇਦਾ ਹੋ ਜੇ ਬਾਹਰ ਜਾ ਕੇ ਅਤੇ ਤੈਨੂੰ ਕੋਈ ਖੱਜਲ ਖਰਾਬੀ ਨਾ ਹੋਏ ਬਾਹਰ ਪੈਸੇ ਵੀ ਲਾਣੇ ਆ ਤੂੰ ਫਿਰ ਜਾ ਕੇ ਉੱਥੇ ਖੱਜਲ ਖਰਾਬ ਹੋ ਜਾਣਾ ਅਤੇ ਕੀ ਫਾਇਦਾ ਅਤੇ ਇੱਥੋਂ ਸਿੱਖਿਆ ਹੋਏਂਗਾ ਅਤੇ ਇਹ ਵਾ ਵੀ ਤੂੰ ਕਿਵੇਂ ਉੱਥੇ ਕਰ ਤਾਂ ਸਕੇਗਾਂ ਨਾ ਕੁਛ ਨਾ ਕੁਛ ਹਾਂ ਨਹੀਂ ਉਹ ਤਾਂ ਗੱਲ ਠੀਕ ਹੈ ਚਲ ਗਏ ਆ ਅਤੇ ਤੂੰ ਕੁਛ ਨਾ ਕੁਛ ਕਰਕੇ ਜਾ ਅਤੇ ਮੈਂ ਜਿਹੜਾ ਜਾ ਕੇ ਬਾਹਰ ਤੂੰ ਖਰਾਬ ਨਾ ਹੋਏ ਖੱਜਲ ਖਰਾਬ ਨਾ ਹੋਏ ਐਵੇਂ ਕੱਲ੍ਹ ਨੂੰ ਉੱਥੇ ਤੂੰ ਚਲ ਜਾਏ ਉੱਥੇ ਨਾ ਤੈਨੂੰ ਕੋਈ ਕੰਮ ਆਉਂਦਾ ਹੈ ਹੱਥੀਂ ਅਤੇ ਕੀ ਕਰੇਗਾ ਉੱਥੇ ਜਾ ਕੇ ਹੈਲੋ ਇੱਥੇ ਹੈ ਵਾ ਥੋੜ੍ਹਾ ਟਾਈਮ ਲਾ ਕੰਮ ਸਿੱਖ ਅਤੇ ਉਹ ਤੈਨੂੰ ਪਤਾ ਲੱਗ ਗਿਆ ਮੈਨੂੰ ਕੰਮ ਕੋਈ ਨਾ ਕੋਈ ਆਉਂਦਾ ਪਿਆ ਫਿਰ ਤੂੰ ਬਾਹਰ ਦਾ ਕਰ ਕਿਉਂਕਿ ਪੈਹੇ ਲਾਏਂਗਾ ਅਤੇ ਉੱਥੇ ਪੈਸੇ ਬੇਕਾਰ ਜਾਣਗੇ ਕੀ ਫਾਇਦਾ ਜਾ ਕੇ ਉੱਥੇ ਤੈਨੂੰ ਕੋਈ ਨਾ ਕੰਮ ਮਿਲਿਆ ਤੈਨੂੰ ਨਾ ਆਇਆ ਕੰਮ ਤਾਂ ਉੱਥੇ ਕੀ ਕਰੇਂਗਾ ਹੈਂ ਅਤੇ ਕ ਕਮ ਸੇ ਕਮ ਐਂ ਤਾਂ ਹੋਏ ਵੀ ਤੂੰ ਕੰਮ ਸਿੱਖਿਆ ਹੱਥੀਂ ਅਤੇ ਤੂੰ ਕਰ ਸਕਣ ਕਰ ਤਾਂ ਲਏਂਗਾ ਨਾ ਹਾਂ ਹਾਂ ਨਹੀਂ ਨਹੀਂ ਚੰਗਾ ਸਿੱਖੀ ਕੰਮ ਕੋਈ ਵੀ ਜਿਹੜਾ ਤੈਨੂੰ ਫਾਇਦਾ ਹੋਏ ਉੱਥੇ ਐਂ ਨਾ ਹੋਏ ਉੱਥੇ ਜਾ ਕੇ ਖੱਜਲ ਖਰਾਬ ਹੋਏ ਅਤੇ ਅਤੇ ਨਾ ਨਹੀਂ ਹੋਰ ਕਿੰਨਾ ਨੀ ਵੀ ਵਧੀਆ ਸਿੱਖ ਲਾ ਕੰਮ ਜਿਹੜਾ ਤੈਨੂੰ ਉੱਥੇ ਜਾ ਕੇ ਜਾਂਦੇ ਤੈਨੂੰ ਕੰਮ ਮਿਲ ਜੇ ਪੈਸੇ ਖਰਚੇ ਅਤੇ ਤੈਨੂੰ ਪਤਾ ਲੱਗ ਜੇ ਹਾਂ ਠੀਕ ਹੈ ਠੀ ਠੀਕ ਆ